ਸਤਿ ਸ਼੍ਰੀ ਅਕਾਲ ਸਰ ਸਰ ਬਸੰਤ ਰੈਸਟੋਰੈਂਟ ਤੋਂ ਗੱਲ ਕਰ ਰਹੇ ਜੀ ਸਰ ਮੈਂ ਸੁੱਖਪਾਲ ਸਿੰਘ ਗੱਲ ਕਰ ਰਿਹਾ ਜੀ ਮੈਂ ਔਡਰ ਦਿੱਤਾ ਸੀ ਜੀ ਪੰਜਾਹ ਸਮੋਸਿਆਂ ਦਾ ਸਰ ਮੈਂ ਇੱਥੇ ਨਾ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਤੁਸੀਂ ਹਰੀ ਚਟਨੀ ਔ ਅ ਦਿੰਦੇ ਆ ਜਿਹੜੀ ਉਹਦੇ ਵਿੱਚੋਂ ਆਉਂਦੀ ਆ ਇੱਕ ਆਉਂਦੀ ਆ ਮਿੱਠੀ ਚਟਨੀ ਉਹ ਮਿੱਠੀ ਚਟਨੀ ਸਰ ਥੋੜ੍ਹੀ ਤੁਸੀਂ ਵੱਧ ਮਾਤਰਾ ਵਿੱਚ ਭੇਜ ਦਿਓ ਚਾਹੇ ਉਹਦੇ ਲਈ ਤੁਸੀਂ ਹਰੀ ਚਟਨੀ ਵਿੱਚੋਂ ਕਟੌਤੀ ਕਰ ਲਿਓ ਕਿਉਂਕਿ ਜਿਹੜੇ ਮੇਰਾ ਸਰਕਲ ਹੈਗਾ ਜਿਹੜੇ ਮੇਰੇ ਦੋਸਤ ਮਿੱਤਰ ਆ ਉਹ ਮਤਲਬ ਮਿਰਚ ਘੱਟ ਖਾਣ ਦੇ ਸ਼ੌਕੀਨ ਆ ਅਤੇ ਇਸ ਲਈ ਸਰ ਬੇਨਤੀ ਆ ਵੀ ਉਹ ਮਿੱਠੀ ਚਟਨੀ ਵੱਧ ਭੇਜ ਦਿਓ ਇਸ ਤੋਂ ਇਲਾਵਾ ਸਰ ਅਗਰ ਜਿਹੜਾ ਸਲਾਦ ਤੁਸੀਂ ਦਿੰਦੇ ਆ ਉਹ ਵੀ ਬੜਾ ਔਰ ਮੈਂ ਪਹਿਲਾਂ ਵੀ ਇਹ ਤੋਂ ਪਹਿਲਾਂ ਵੀ ਔਡਰ ਕਰ ਚੁੱਕਾ ਹਾਂ ਉਹ ਵੀ ਵਧੀਆ ਹੁੰਦਾ ਆ ਜਿਹਦੀ ਤੁਹਾਡੀ ਕੁਆਲਿਟੀ ਵੀ ਬਹੁਤ ਵਧੀਆ ਆ ਇਸ ਲਈ ਮੈਂ ਪਹਿਲੇ ਵੀ ਔਡਰ ਕੀਤਾ ਸੀ ਕੁਛ ਦਿਨ ਪਹਿਲੇ ਇਸ ਲਈ ਉਹਦੀ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਉਹ ਵੀ ਤੁਸੀਂ ਵੱਧ ਮਾਤਰਾ 'ਚ ਭੇਜ ਦਿਓ ਇਹਦੇ ਤੁਸੀਂ ਕੁਛ ਵਾਧੂ ਚਾਰਜਿਸ ਲਉਗੇ ਜੀ ਜਾਂ ਜਿੰਨਾ ਮਤਲਬ ਬਣਿਆ ਆ ਉਹਦੇ ਵਿੱਚ ਹੈ ਸਰ ਅਗਰ ਵਾਧੂ ਚਾਰਜਿਸ ਤੁਸੀਂ ਲੈਣੇ ਆ ਤਾਂ ਤੁਸੀਂ ਮੈਨੂੰ ਦੱਸ ਦਿਉ ਮੈਂ ਉਹਦੇ ਲਈ ਭੁਗਤਾਨ ਕਰ ਦੁੰਗਾ ਜੀ ਧੰਨਵਾਦ ਜੀ